ਵੰਡ ਤੋਂ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਅਤੇ ਵੰਡ ਤੋਂ ਬਾਅਦ ਇਸਦੇ ਬਹੁਤ ਹਿੱਸਿਆਂ ਵਿੱਚ ਪੰਜਾਬ ਵੰਡਿਆ ਗਿਆ ਜਿਵੇਂ ਕਿ ਹੁਣ ਪੰਜਾਬ ਵਿੱਚੋਂ ਹਰਿਆਣਾ ਨਿਕਲਿਆ ਹਿਮਾਚਲ ਨਿਕਲਿਆ ਮੇਨ ਪੰਜਾਬ ਵਿੱਚੋਂ ਜੋ ਚੰਡੀਗੜ੍ਹ ਨਿਕਲਿਆ ਪਹਿਲਾਂ ਲੋਕਾਂ ਨੂੰ ਕਿਹਾ ਗਿਆ ਕਿ ਇਹ ਪੰਜਾਬ ਦਾ ਹੈ ਅਤੇ ਬਾਅਦ ਵਿੱਚ ਅੱਜ ਦੇ ਮਾਹੌਲ 'ਚ ਹੁਣ ਇਸ ਨੂੰ ਪੰਜਾਬ ਨਾਲੋਂ ਵੱਖ ਕੀਤਾ ਜਾ ਰਿਹਾ ਹੈ ਅਤੇ ਇਹ ਪੰਜਾਬ ਲਈ ਬਹੁਤ ਮਤਲਬ ਵਧੀਆ ਗੱਲ ਨਹੀਂ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬ ਬਣਾਇਆ ਗਿਆ ਸੀ ਅਤੇ ਲੋਕਾਂ ਨੇ ਸੋਚਿਆ ਸੀ ਕਿ ਬਹੁਤ ਸਾਡੇ ਲਈ ਵਧੀਆ ਚੀਜ਼ ਹੋਵੇਗੀ ਲੇਕਿਨ ਅੱਜ ਦੇ ਇਸ ਹੁਣ ਅਸੀਂ ਇਸਦੇ ਟਾਈਮ ਦੇਖੀਏ ਚੰਡੀਗੜ੍ਹ ਵਿੱਚ ਪੰਜਾਬ ਦੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਅਤੇ ਜਿੰਨੇ ਹੰਡ ਸੌ ਪ ਪ੍ਰਤੀਸ਼ਤ ਵਿੱਚੋਂ ਸਿਰਫ਼ ਦਸ ਪ੍ਰਸੈਂਟ ਪੰਜਾਬੀ ਹੀ ਚੰਡੀਗੜ੍ਹ ਵਿੱਚ ਰਹਿੰਦੇ ਹਨ ਅਤੇ ਬਾਕੀ ਦੂਜੀਆਂ ਸਟੇਟਾਂ ਵਿੱਚੋਂ ਆ ਕੇ ਚੰਡੀਗੜ੍ਹ ਵਿੱਚ ਲੋਕ ਵੱਸ ਗਏ ਹਨ ਇਸ ਲਈ ਪੰਜਾਬ ਦਾ ਰਿਸ਼ਤਾ ਚੰਡੀਗੜ੍ਹ ਨਾਲੋਂ ਤਕਰੀਬਨ ਦਸ ਕੁ ਪ੍ਰਸੈਂਟ ਹੀ ਏ ਹੀ ਹੈ ਅਤੇ ਪੰਜਾਬ ਦੇ ਲੋਕ ਇਸ ਗੱਲ ਤੋਂ ਨਿਰਾਸ਼ ਹਨ ਇਸ ਲਈ ਭਾਰਤ ਨਾਲ਼ ਪੰਜਾਬ ਦਾ ਰਿਸ਼ਤਾ ਥੋੜ੍ਹਾ ਬਦਲਿਆ ਹੈ